ਅਸੀਂ ਇਸ ਸਮਾਗਮ ਦੀ ਯੋਜਨਾ ਇਸ ਤਰੀਕੇ ਨਾਲ ਬਣਾਉਣਾ ਚਾਹੁੰਦੇ ਹਾਂ ਕਿ ਇਹ ਸਾਡੇ ਪ੍ਰਿਯ ਪਿਆਰੇ ਮੁਕੇਸ਼ ਜੀ ਦੀ ਯਾਦ ਨੂੰ ਸਤਿਕਾਰ ਦੇਵੇ ਇਸ ਸਮੇਂ ਇਹ ਵੀ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਉਨ੍ਹਾਂ ਦੀ ਮੌਤ ਅਧਿਕਾਰਿਤ ਤੌਰ 'ਤੇ ਦਰਜ ਹੈ ਇਹ ਲੋੜੀਂਦਾ ਹੈ ਤਾਂ ਜੋ ਕੋਈ ਭਵਿੱਖੀ ਅੜ ਅੜਚਨ ਨਾ ਆਏ ਖਾਸ ਕਰਕੇ ਜੇਕਰ ਅਸੀਂ ਉਨ੍ਹਾਂ ਦੀ ਯਾਦਗਾਰੀ ਨੂੰ ਸੰਭਾਲਣ ਜਾਂ ਕਾਨੂੰਨੀ ਦਸਤਾਵੇਜ਼ਾਂ ਦੀ ਜ਼ਰੂਰਤ ਪਈ ਅਸੀਂ ਸਰਕਾਰੀ ਰਿਕੋਡ ਜਾਂ ਪੰਜੀਕਰਨ ਦਫਤਰ ਵਿੱਚ ਜਾਂਚ ਕਰ ਸਕਦੇ ਹਾਂ ਕਿ ਉਨ੍ਹਾਂ ਦੀ ਮੌਤ ਦਾ ਰਜਿਸਟਰੇਸ਼ਨ ਹੋਈ ਹੈ ਜਾਂ ਨਹੀਂ ਜੇਕਰ ਲੋੜ ਹੋਈ ਤਾਂ ਅਸੀਂ ਅਧਿਕਾਰਿਤ ਦਸਤਾਵੇਜ਼ ਪ੍ਰਾਪਤ ਕਰ ਸਕਦੇ ਹਾਂ ਮੈਂ ਇਸ ਪ੍ਰੀਖਿਆ ਪ੍ਰੀ ਪ੍ਰੀਕਿਰਿਆ ਵਿੱਚ ਅਗਵਾਈ ਕਰਨ ਲਈ ਤਿਆਰ ਹਾਂ ਤਾਂ ਜੋ ਇਹ ਕੰਮ ਜਲਦੀ ਅਤੇ ਠੀਕ ਤਰੀਕੇ ਨਾਲ ਹੋ ਜਾਵੇ ਠੀਕ ਹੈ ਮੈਂ ਆਪਣਾ ਮੈਂ ਪਹਿਲਾਂ ਅਧਿਕਾ ਅਧਿਕਾਰਿਤ ਦਫਤਰ ਜਾਂ ਔਨਲਾਈਨ ਪਲੈਟਫੋਮ ਰਾਹੀਂ ਜਾਂਚ ਕਰਾਂਗਾ ਅਤੇ ਫੇਰ ਇਸ ਅਸੀਂ ਅੱਗੇ ਦੀ ਕਾਰਵਾਈ ਦੀ ਯੋਜਨਾ ਬਣਾਵਾਂਗੇ